ਮੈਂ ਮੋਹਾਲੀ ਜ਼ਿਲ੍ਹੇ ਦੇ ਇੱਕ ਪਿੰਡ ਦੀ ਨਿਵਾਸੀ ਹਾਂ ਅਤੇ ਪਿੰਡ ਵਿੱਚ ਰਹਿਣ ਦੇ ਬਾਵਜੂਦ ਅਸੀਂ ਘਰੇਲੂ ਨੁਸਖਿਆਂ ਦਾ ਪ੍ਰਯੋਗ ਕਰਦੇ ਹਾਂ ਅਤੇ ਇਹ ਪ੍ਰਯੋਗ ਸਾਨੂੰ ਸਾਡੀ ਦਾਦੀ ਅਤੇ ਮਾਤਾ ਜੀ ਵੱਲੋਂ ਮਿਲੇ ਹਨ ਜਦੋਂ ਵੀ ਗਲ ਖਰਾਬ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗਰਾਰੇ ਗਰਮ ਪਾਣੀ ਦੇ ਗਰਾਰੇ ਕਰਦੇ ਹਾਂ ਇਸ ਤੋਂ ਇਲਾਵਾ ਅਸੀਂ ਅਦਰਕ ਵਿੱਚ ਸ਼ਹਿਦ ਮਿਲਾ ਕੇ ਉਸਨੂੰ ਲੈਂਦੇ ਹਾਂ ਅਤੇ ਉਸ ਨਾਲ ਸ ਗਲਾ ਠੀਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕਿਸਮ ਦੇ ਕਾੜ੍ਹੇ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪੀ ਕੇ ਗਲਾ ਤੰਦਰੁਸਤ ਹੋ ਸਕਦਾ ਹੈ